ਸਤਿ ਸ਼੍ਰੀ ਅਕਾਲ ਮੈਂ ਲੁਧਿਆਣਾ ਤੋਂ ਗੱਲ ਕਰ ਰਿਹਾ ਹਾਂ ਮੈਂ ਇੱਕ ਨਵਾਂ ਕੈਮਰਾ ਆਨਲਾਈਨ ਮੰਗਵਾਇਆ ਪਰ ਜਿਵੇਂ ਹੀ ਉਹ ਹੱਥ ਵਿੱਚ ਆਇਆ ਤਾਂ ਮੈਂ ਬਹੁਤ ਨਿਰਾਸ਼ ਹੋ ਗਿਆ ਆਓ ਤੁਹਾਨੂੰ ਆਪਣਾ ਤਜ਼ਰਬਾ ਦੱਸਦਾ ਹਾਂ ਤਾਂ ਜੋ ਤੁਸੀਂ ਵੀ ਸਾਵਧਾਨ ਰਹੋ ਪਹਿਲੀ ਗੱਲ ਤਾਂ ਡਿਲੀਵਰੀ ਹੀ ਬਹੁਤ ਲੇਟ ਹੋਈ ਉਹਨਾਂ ਨੇ ਕਿਹਾ ਸੀ ਕਿ ਪੰਜ ਦਿਨਾਂ ਵਿੱਚ ਆ ਜਾਵੇਗਾ ਬਾਰ੍ਹਾਂ ਦਿਨ ਲੱਗ ਗਏ ਮੈਨੂੰ ਲੱਗਾ ਸ਼ਾਇਦ ਕੋਈ ਠੀਕ ਕੰਪਨੀ ਹੋਵੇਗੀ ਇਸ ਲਈ ਵਧੀਆ ਉਤਪਾਦ ਮਿਲੇਗਾ ਪਰ ਜਦੋਂ ਪੈਕਜ ਖੁੱਲਿਆ ਖੋਲਿਆ ਤਾਂ ਪੂਰੀ ਤਰ੍ਹਾਂ ਮਾੜੀ ਪੈਕਨ ਸੀ ਬਾਕਸ ਦੇ ਕੋਨੇ ਤੱਕ ਪਾਟੇ ਹੋਏ ਸਨ ਅਤੇ ਕੈਮਰੇ 'ਤੇ ਪੇਂਟ ਦੀ ਇੱਕ ਛੋਟੀ ਕ੍ਰੀਚ ਵੀ ਸੀ ਜਿਵੇਂ ਉਹ ਪਹਿਲਾਂ ਹੀ ਵਰਤਿਆ ਗਿਆ ਹੋਵੇ ਫਿਰ ਜਦੋਂ ਕੈਮਰਾ ਚਾਲੂ ਕੀਤਾ ਤਾਂ ਹੋਰ ਵੀ ਵੱਡੀ ਮੁਸੀਬਤ ਨਿਕਲੀ ਅਮੇਜ਼ ਕੁਆਲਿਟੀ ਬਹੁਤ ਹੀ ਘਟੀਆ ਨਾ ਫੋਕਸ ਠੀਕ ਲੱਗ ਰਿਹਾ ਸੀ ਨਾ ਹੀ ਕਲੀਅਰੈਂਸ ਕਲੀਅਰੈਂਸ ਆ ਰਹੀ ਸੀ ਵਾਈਫਾਈ ਕਨੈਕਸ਼ਨ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ ਜਦ ਕਿ ਵੇਰਵਾ ਵਿੱਚ ਲਿਖਿਆ ਹੋਇਆ ਸੀ ਕਿ ਬਹੁਤ ਹੀ ਤੇਜ਼ ਹੋਵੇਗਾ ਬੈਟਰੀ 'ਤੇ ਤਾਂ ਹੱਸਣ ਦਾ ਮਨ ਕਰ ਰਿਹਾ ਹੈ ਬਹੁਤ ਘਟੀਆ ਦੋ ਘੰਟਿਆਂ ਵਿੱਚ ਪੂਰੀ ਖਤਮ ਬਟਨ ਵੀ ਢਿੱਲੇ ਜਾਪ ਰਹੇ ਹਨ ਜਿਵੇਂ ਬਹੁਤ ਜ਼ਿਆਦਾ ਵਰਤੇ ਹੋਣ ਹੁਣ ਅਸੀਂ ਗੱਲ ਕਰੀਏ ਕਸਟਮਰ ਸਰਵਿਸ ਦੀ ਜਦੋਂ ਮੈਂ ਕਸਟਮਰ ਕੇਅਰ 'ਤੇ ਕਾਲ ਕੀਤੀ ਤਾਂ ਉਹ ਬਸ ਭੁੱਲੇ ਭੁੱਲੇ ਜਵਾਬ ਦਿੰਦੇ ਰਹੇ ਪਹਿਲਾਂ ਤਾਂ ਕਿਸੇ ਨੇ ਕਾਲ ਹੀ ਨਹੀਂ ਚੁੱਕੀ ਫਿਰ ਜਦੋਂ ਚੁੱਕੀ ਤਾਂ ਕਹਿਣ ਲੱਗੇ ਜੀ ਆਪਾਂ ਵੇਖਦੇ ਹਾਂ ਤੁਸੀਂ ਚੌਵੀ ਘੰਟੇ ਉਡੀਕੋ ਚੌਵੀ ਨਹੀਂ ਅਠਤਾਲੀ ਘੰਟੇ ਹੋ ਗਏ ਪਰ ਹਾਲੇ ਤੱਕ ਕੋਈ ਗੱਲ ਕੋਈ ਹੱਲ ਨਹੀਂ ਹੋਇਆ ਫਿਰ ਜਦੋਂ ਰਿਫੰਡ ਮੰਗਿਆ ਤਾਂ ਕਹਿਣ ਲੱਗੇ ਉਹ ਤਾਂ ਜੀ ਸਾਡੀ ਪਾਲਸੀ 'ਚ ਨਹੀਂ ਆਉਂਦਾ ਹੁਣ ਦੱਸੋ ਇਹ ਕੋਈ ਗੱਲ ਹੋਈ ਇਸ ਤਜ਼ਰਬੇ ਨੇ ਮੈਨੂੰ ਇੱਕ ਵੱਡਾ ਸਬਕ ਮਿਲਿਆ ਹੈ ਕਿ ਆਨਲਾਈਨ ਖਰੀਦਣ ਤੋਂ ਪਹਿਲਾਂ ਰਿਵਿਊ ਜਰੂਰ ਪੜੋ ਹਰ ਵੈੱਬਸਾਈਟ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਮੈਂ ਹੁਣ ਕਦੇ ਵੀ ਇਸ ਤਰ੍ਹਾਂ ਦਾ ਧੋਖਾ ਨਹੀਂ ਖਾਵਾਂਗਾ ਅਤੇ ਤੁਸੀਂ ਵੀ ਸਾਵਧਾਨ ਰਹੋ ਜੈ ਹਿੰਦ ਧੰਨਵਾਦ